ਰਨਿੰਗ ਕਰਨ ਨਾਲ਼ ਸਾਨੂੰ ਤੰਦਰੁਸਤ ਰਹਿਣ ਵਿੱਚ ਬਹੁਤ ਮਦਦ ਮਿਲੇਗੀ ਮਿਲਦੀ ਹੈ ਰਨਿੰਗ ਨਾਲ਼ ਸਾਡੀਆਂ ਕਈ ਸਰੀਰ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਇਹ ਰਨਿੰਗ ਨਾਲ਼ ਸਾਡੀਆਂ ਇਹ ਦਿਲ ਦੀ ਕੋਈ ਰੋਗ ਲੱਗਣ ਦੀ ਸੰਭਾਵਨਾ ਬਹੁਤ ਘੱਟਦੀ ਹੈ ਰਨਿੰਗ ਨਾਲ਼ ਇਹ ਆਪਾਂ ਵੇਟ ਲੋਸ ਕਰ ਸਕਦੇ ਹਾਂ ਜੇ ਪਤਲੇ ਹੋ ਸਕਦੇ ਹਾਂ ਚੰਗੀ ਸਿਹਤ ਲਈ ਰਨਿੰਗ ਨਾਲ਼ ਸਾਡੇ ਸਰੀਰ ਦੇ ਕਈ ਤਰ੍ਹਾਂ ਦੇ ਮੱਸਲ ਵੀ ਡਿਵਲਪ ਹੁੰਦੇ ਹਨ ਅਤੇ ਸਟ੍ਰੈਂਥਨ ਵੱਧਦੀ ਹੈ ਰਨਿੰਗ ਨਾਲ਼ ਆਪਾਂ ਆਪਣਾ ਬੋਨ ਨੂੰ ਵੀ ਸਟ੍ਰੋਂਗ ਆਪਣੀਆਂ ਬੋਨਸ ਨੂੰ ਆਪਣੀਆਂ ਹੱਡੀਆਂ ਨੂੰ ਵੀ ਸਟ੍ਰੋਂਗ ਕਰ ਸਕਦੇ ਹਾਂ ਰਨਿੰਗ ਸਾਡੀ ਮੈਟਲ ਹੈਲਥ ਨੂੰ ਵੀ ਇਫੈਕਟ ਕਰਦੀ ਹੈ ਪ ਪੌਜੀਟਿਵ ਰੱਖਦੀ ਹੈ ਇੰਮਪਰੂਵ ਕਰਦੀ ਹੈ ਸਾਡੀ ਮੈਟਲ ਹੈਲਥ ਨੂੰ ਅਤੇ ਸਾਡਾ ਫਿਰ ਮੂਡ ਮੂਡ ਪੌਜੀਟਿਵ ਰਹਿੰਦਾ ਹੈ ਰਨਿੰਗ ਨਾਲ਼ ਸਾਡੇ ਫੇਫੜਿਆਂ 'ਤੇ ਵੀ ਕਾਫ਼ੀ ਪੌਜੀਟਿਵ ਇਫੈਕਟ ਪੈਂਦਾ ਆ ਅਤੇ ਫੇਫੜਿਆਂ ਦੀ ਹੈਲਥ ਵੀ ਠੀਕ ਰਹਿੰਦੀ ਹੈ ਰਨਿੰਗ ਨਾਲ਼ ਸਾਡੇ ਬੌਡੀ ਦਾ ਸਟੈਮਿਨਾ ਵੱਧਦਾ ਹੈ ਰਨਿੰਗ ਨਾਲ਼ ਸਾਡੇ ਸਾਡੀ ਇੰਮਊਨਟੀ ਸਾਡੇ ਸਰੀਰ ਦੀ ਇੰਮਊਨਟੀ ਵੱਧਦੀ ਹੈ ਡੇਲੀ ਰਨਿੰਗ ਨਾਲ਼ ਸਾਡੀ ਡੇਲੀ ਸਲੀਪ ਸਲੀਪ ਵੀ ਇੰਪਰੂ ਇੰਮਪਰੂਵ ਹੁੰਦੀ ਹੈ ਅਤੇ ਚੰਗੀ ਚੰਗੇ ਚੰਗੀ ਸਲੀਪ ਆਉਂਦੀ ਹੈ ਇਸ ਨਾਲ਼ ਆਪਾਂ ਜੇ ਆਪਣੇ ਫ੍ਰੈਂਡਜ਼ ਨਾਲ਼ ਫ੍ਰੈਂਡ ਸਲ ਸਰਕਲ 'ਚ ਜੇ ਆਪਾਂ ਰਨਿੰਗ ਕਰੀਏ ਤਾਂ ਸਾਡਾ ਸੋਸ਼ਲ ਸਕਰਲ ਵੀ ਵੱਧਦਾ ਆ